ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਹਾਂਜੀ ਬੋਲੋ ਠੀਕ ਹੈ ਜੀ ਬਾਈ ਤਰੀਕ ਨੂੰ ਇੱਕ ਮਿੰਟ ਚੈੱਕ ਕਰ ਲੈਂਦੇ ਹਾਂ ਠੀਕ ਹੈ ਜੀ ਬਾਈ ਤਰੀਕ ਨੂੰ ਫਰੀ ਹਾਂ ਬਾਕੀ ਡੇਟਾਂ ਤਾਂ ਫੁੱਲ ਨੇ ਠੀਕ ਹੈ ਜੀ ਆਪਾਂ ਜੀ ਦੇਖੋ ਬਾਈ ਸੌ ਲੈਂਦੇ ਹਾਂ ਜੀ ਉੱਦਾਂ ਤਾਂ ਅਤੇ ਬਾਈ ਸੌ ਲੈਂਦੇ ਹਾਂ ਅਤੇ ਤੁਸੀਂ ਟਾਈਮਿੰਗ ਵਗੈਰਾ ਦੱਸ ਦਿਓ ਵੀ ਮਤਲਬ ਦਿਨੇ ਹੋਊ ਜਾਂ ਰਾਤ ਨੂੰ ਹੋਊਗਾ ਅਤੇ ਠੀਕ ਹੈ ਜੀ ਅਤੇ ਫਿਰ ਰਾਤ ਨੂੰ ਜਿਵੇਂ ਆਪਾਂ ਮਤਲਬ ਅੱਠ ਤੋਂ ਦਸ ਲਈਏ ਤਾਂ ਬਾਈ ਸੌ ਲਵਾਂਗੇ ਜੀ ਦੋ ਘੰਟਿਆਂ ਦਾ ਨਹੀਂ ਨਹੀਂ ਗਾਣੇ ਗਾਣੇ ਸਾਰੇ ਅਵੇਲੇਬਲ ਹੈ ਜੋ ਮਰਜ਼ੀ ਤੁਸੀਂ ਕਹੋ ਗਾਣੇ ਉਹ ਅਤੇ ਉਹ ਤੁਹਾਡੀ ਡਿਮਾਂਡ 'ਤੇ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਉਹ ਤਾਂ ਠੀਕ ਉਹ ਓ ਉਹ ਦੇਖ ਲਾਂਗੇ ਅਸੀਂ ਨਹੀਂ ਨਹੀਂ ਬੁੱਕ ਤਾਂ ਦੇਖੋ ਜੀ ਕਰ ਲਾਂਗੇ ਤੇ ਤੁਸੀਂ ਥੋੜ੍ਹਾ ਸਾਨੂੰ ਮਤਲਬ ਵੀ ਡਿਟੇਲ ਸਾਰੀ ਭੇਜ ਦਿਓ ਜਿਵੇਂ ਕਿ ਡੇਟ ਵਗੈਰਾ ਹੋ ਗਈ ਅਤੇ ਟਾਈਮਿੰਗ ਵਗੈਰਾ ਹੋ ਗਈ ਅਤੇ ਪਲੇਸ ਵਗੈਰਾ ਹੋ ਗਈ ਤਾਂ ਉਹ ਸਾਰਾ ਕੁਝ ਤੁਸੀਂ ਭੇਜ ਦਿਓ

ਓਕੇ ਓਕੇ ਧੰਨਵਾਦ ਜੀ